ਮੈਂ ਅੰਮ੍ਰਿਤਸਰ ਦੀ ਯਾਤਰਾ ਦੀ ਯੋਜਨਾ ਬਣਾ ਰਹੀ ਹਾਂ ਇਸ ਲਈ ਮੈਂ ਆਪਣੇ ਆਪਣੇ ਜਾਣ ਲਈ ਬਜਟ ਅਤੇ ਟ੍ਰੇਨ ਦੇ ਵੇਰਵਿਆਂ ਨੂੰ ਜੋੜਿਆ ਹੈ ਬਚਤ ਬਰੇਦ ਹਾਲਾਂਕਿ ਮੈਂ ਅੰਮ੍ਰਿਤਸਰ ਦੇ ਸਮੁੱਚੇ ਖਾਸ ਜਾਣਕਾਰੀ ਨਹੀਂ ਪ੍ਰਾਪਤ ਕਰ ਸਕੀ ਪਰ ਇੱਥੇ ਵਿਚਾਰ ਕਰਨ ਲਈ ਕੁਝ ਅਨੁਮਾਨਿਤ ਲਾਗਤਾਂ ਲਗਾਈਆਂ ਹਨ ਰਿਹਾਇਸ਼ ਹੋਟਲ ਜਾਂ ਡਰੈਸਟ ਹਾਊਸ ਲਈ ਪੰਦਰ੍ਹਾਂ ਸੌ ਰੁਪਏ ਪ੍ਰਤੀ ਰਾਤ ਦਿਨ ਭੋਜਨ ਮੱਧ ਰੇਂਜ ਦੇ ਰੈਸਟੋਰੈਂਟਾਂ ਲਈ ਰੁਪਏ ਦੋ ਸੌ ਤੋਂ ਪੰਜ ਸੌ ਪ੍ਰਤੀ ਭੋਜਨ ਆਵਾਜਾਈ ਸਥਾਨਕ ਯਾਤਰਾ ਲਈ ਰੁਪਏ ਪੰਜ ਸੌ ਤੋਂ ਰੁਪਏ ਹਜ਼ਾਰ ਆ ਪਰਸ਼ਨ ਪਰਵੇਸ਼ ਫੀਸ ਲਈ ਰੁਪਏ ਪੰਜਾਹ ਤੋਂ ਰੁਪਏ ਦੋ ਸੌ ਪ੍ਰਤੀ ਵਿਅਕਤੀ ਰੇਲ ਬੁਕ ਰੇਲ ਬੁਕਿੰਗ ਵੇਰਵੇ ਦਿੱਲੀ ਤੋਂ ਅੰਮ੍ਰਿਤਸਰ ਲਈ ਕਈ ਟ੍ਰੇਨਾਂ ਹਨ ਵੱਖ ਵੱਖ ਸਮਾਂ ਸਾਰਣੀ ਅਤੇ ਕਿਰਾਏ ਦੇ ਨਾਲ ਇੱਥੇ ਕੁਝ ਵਿਕਲਪ ਹਨ ਏ ਐੱਸ ਆਰ ਸ਼ਤਾਬਦੀ ਐਸਪਰੈਸ ਇਹ ਦੋ ਜੀਰੋ ਦੋ ਨੌ ਨਵੀਂ ਦਿੱਲੀ ਤੋਂ ਸਵੇਰੇ ਸੱਤ ਵਜ ਕੇ ਵੀਹ ਮਿੰਟ ਰਵਾਨਾ ਹੁੰਦੀ ਹੈ ਅੰਮ੍ਰਿਤਸਰ ਜੰਕਸ਼ਨ 'ਤੇ ਦੁਪਹਿਰ ਇੱਕ ਵਜ ਕੇ ਪੰਤਾਲੀ ਮਿੰਟ 'ਤੇ ਪਹੁੰਚਦੀ ਹੈ ਬਿਹਤਰ ਦਰਾਂ ਨੂੰ ਸੁਰੱਖਿਅਤ ਕਰਨ ਲਈ ਆਪਣੀਆਂ ਟਿਕਟਾਂ ਪਹਿਲਾਂ ਹੀ ਬੁੱਕ ਕਰਵਾਓ ਹੋਰ ਵਿਕਲਪਾਂ ਲਈ ਤਿਉਹਾਰਾਂ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ ਜਾਂ ਕੋਵਿਡ ਵਿਸ਼ੇਸ਼ ਰੇਲ ਗੱਡੀਆਂ ਦੀ ਜਾਂਚ ਕਰੋ